ਕਿਸਾਨਾਂ ਦੀ ਖ਼ੁਦਕੁਸ਼ੀ ਕਰਨ ਦੇ ਬਹੁਤ ਜ਼ਿਆਦਾ ਕਾਰਣ ਹਨ ਜਿਵੇਂ ਹੜ੍ਹਾਂ ਦਾ ਆ ਜਾਣਾ ਸੂਇਆਂ ਦਾ ਟੁੱਟ ਜਾਣਾ ਫਸਲ ਦਾ ਫਸਲ ਦੇ ਉੱਪਰ ਗੜ੍ਹੇ ਮਾਰੀ ਪੈ ਜਾਣਾ ਜਾਂ ਸ ਕਿਸਾਨ ਦੇ ਸਿਰ 'ਤੇ ਕਰਜ਼ਾ ਹੋਣਾ ਇਸ ਵਿੱਚ ਕਿਸਾਨ ਦੇ ਕੋਲ ਆਮਦਨ ਦਾ ਜਦੋਂ ਕੋਈ ਵੀ ਸਾਧਨ ਨਹੀਂ ਹੁੰਦਾ ਤਾਂ ਕਿਸਾਨ ਕੋਲ ਇੱਕ ਹੀ ਆਪਸ਼ਨ ਬਚਦੀ ਹੈਗੀ ਹੈ ਜਿਹੜਾ ਉਹ ਖ਼ੁਦਕੁਸ਼ੀ ਕਰ ਲੈਂਦਾ ਹੈਗਾ ਗਾ ਅਤੇ ਖ਼ੁਦਕੁਸ਼ੀ ਕਰਕੇ ਉਹ ਆਪਣੀ ਜਿਹੜੀ ਹੈਗੀ ਹੈ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈਗਾ ਗਾ ਇਸਦੇ ਵਿੱਚ ਜਿਹੜੀ ਹੈਗੀ ਹੈਗੀ ਰਾਜ ਸਰਕਾਰ ਅਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਵੀ ਕਿਸਾਨਾਂ ਦੀ ਖ਼ੁਦਕੁਸ਼ੀ ਨੂੰ ਬਚਾਉਣ ਵਾਸਤੇ ਬਹੁਤ ਜ਼ਿਆਦਾ ਜਿਹੜੇ ਹੈਗੇ ਹੈਗੇ ਟੋਲ ਫ੍ਰੀ ਨੰਬਰ ਜਿਹੜੇ ਹੈਗੇ ਹੈਗੇ ਉਹ ਜਾਰੀ ਕਰ ਰਹੀ ਹੈਗੀ ਹੈਗੀ ਜਿਸ ਰਾਹੀਂ ਕਿਸਾਨਾਂ ਦੀ ਜਿਹੜੀ ਖ਼ੁਦਕੁਸ਼ੀ ਹੈਗੀ ਹੈਗੀ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈਗਾ ਗਾ ਅਤੇ ਡਿਸਟਿਕ ਜਿਹੜੇ ਐਗਰੀਕਲਚਰ ਮਨਿਸਟਰ ਹੈਗੇ ਹੈਗੇ ਉਹ ਵੀ ਕਿਸਾਨਾਂ ਨੂੰ ਬਹੁਤ ਵਧੀਆ ਸਲਾਹ ਦੇ ਰਹੇ ਹੈ ਵੀ ਕਿਵੇਂ ਕਿਵੇਂ ਉਹ ਮੁਸ਼ਕਿਲਾਂ ਦਾ ਹੱਲ ਕਰ ਸਦਕੇ ਹੈਗੇ ਆ ਖ਼ੁਦਕੁਸ਼ੀ ਕਰਨਾ ਹੀ ਸਿਰਫ਼ ਇੱਕ ਹੱਲ ਨਹੀਂ ਹੁੰਦਾ ਉਹ ਉਹਨਾਂ ਨੂੰ ਸਲਾਹ ਦੇ ਰਹੇ ਹੈਗੇ ਹੈਗੇ ਕਿਸ ਤਰ੍ਹਾਂ ਉਹਨਾਂ ਨੇ ਇਸ ਤਰ੍ਹਾਂ ਦੇ ਮੋਕਿਆਂ ਦੇ ਵਿੱਚ ਸਰਵਾਈਵ ਕਰਨਾ ਹੈਗਾ ਗਾ ਕਿਸ ਤਰ੍ਹਾਂ ਉਹਨਾਂ ਨੇ ਹਾਲਾਤਾਂ ਨੂੰ ਜਿਹੜਾ ਹੈਗਾ ਗਾ ਹੈਂਡਲ ਕਰਨਾ ਹੈਗਾ ਗਾ ਕਿਉਂਕਿ ਉਹ ਵੀ ਇੱਕ ਕਿਸਾਨ ਪਰਿਵਾਰ ਨੂੰ ਹੀ ਬਿਲੋਂਗ ਕਰਦੇ ਹਨ ਅਤੇ ਜਦੋਂ ਕਿਸਾਨ ਖ਼ੁਦਕੁਸ਼ੀ ਕੇ ਲੈਂਦਾ ਹੈਗਾ ਤਾਂ ਉਸਦੇ ਜਿਹੜਾ ਹੈਗਾ ਪਿੱਛਲਾ ਪਰਿਵਾਰ ਜਿਹੜਾ ਹੈਗਾ ਉਹ ਬਹੁਤ ਮੁਸ਼ਕਿਲਾਂ ਦੇ ਵਿੱਚ ਪੈ ਜਾਂਦਾ ਹੈਗਾ ਗਾ ਜਿਵੇਂ ਕਿਸਾਨ ਦੇ ਵਿੱਚ ਕੋਈ ਵੀ ਉਹਦਾ ਅੱਗੇ ਖੇਤੀ ਕਰਨ ਵਾਲਾ ਕੋਈ ਨਹੀਂ ਹੁੰਦਾ ਬੱਚੇ ਛੋਟੇ ਹੁੰਦੇ ਹਨ ਅਤੇ ਕੋਈ ਵੀ ਆਮਦਨ ਦਾ ਜਿਹੜਾ ਹੈਗਾ ਸਾਧਨ ਨਹੀਂ ਬਣਦਾ ਅਤੇ ਇਸ ਤਰ੍ਹਾਂ ਜਿਹੜਾ ਹੈਗਾ ਗਾ ਕਿਸਾਨ ਜਿਹੜਾ ਹੈਗਾ ਗਾ ਜਦੋਂ ਖ਼ੁਦਕੁਸ਼ੀ ਕਰ ਲੈਂਦਾ ਤਾਂ ਉਹ ਆਪਣੀ ਤਾਂ ਜੀਵਨ ਲੀਲਾ ਸਮਾਪਤ ਕਰ ਲੈਂਦਾ ਬੱਟ ਉਹ ਆਪਣੇ ਪਰਿਵਾਰ ਨੂੰ ਵੀ ਜਿਹੜਾ ਹੈਗਾ ਗਾ ਬਹੁਤ ਜ਼ਿਆਦਾ ਮੁਸ਼ਕਿਲਾਂ ਦੇ ਵਿੱਚ ਪਾ ਲੈਂਦਾ ਹੈਗਾ ਗਾ ਸੋ ਸਿਰਫ਼ ਖ਼ੁਦਕੁਸ਼ੀ ਕਰਨਾ ਹੀ ਇੱਕ ਜਿਹੜਾ ਹੈਗਾ ਹੱਲ ਨਹੀਂ ਹੈਗਾ ਇਸਦੇ ਨਾਲ ਜਿਹੜਾ ਹੈਗਾ ਗਾ ਪਰਿਵਾਰ ਨੂੰ ਬਹੁਤ ਜ਼ਿਆਦੀਆਂ ਮੁਸੀਬਤਾਂ ਜ ਜਿਹੜੀਆਂ ਝੱਲਣੀਆਂ ਪੈਂਦੀਆਂ ਹਨ